ਸ ਸਾਡੇ ਖੇਤਰ ਵਿੱਚ ਰੋਪੜ ਵੈੱਟਲੈਂਡ ਵਪਾਰੀ ਗਤੀਵਿਧੀਆਂ ਲਈ ਵਰਤੇ ਜਾ ਜਾ ਰਿਹਾ ਹੈ ਜਿਸ ਨੂੰ ਰੋਪੜ ਝੀਲ ਵੀ ਕਿਹਾ ਜਾਂਦਾ ਹੈ ਮਨੁੱਖ ਦੁਆਰਾ ਬਣਾਈ ਗਈ ਤਾਜ਼ੇ ਪਾਣੀ ਦੀ ਨਦੀ ਅਤੇ ਵੈੱਟਲੈਂਡ ਹੈ ਇਸ ਖੇਤਰ ਵਿੱਚ ਘੱਟੋ ਘੱਟ ਨੌ ਥਣਧਾਰੀ ਜਾਨਵਰ ਇੱਕ ਸੌ ਚੁਰੰਜਾ ਮੱਛਲੀ ਪੈਂਤੀ ਪੰਛੀਆਂ ਪੰਛੀਆਂ ਅਤੇ ਨੌ ਹਨ ਉੱਨੀ ਸੌ ਬਵੰਜਾ ਵਿੱਚ ਸਤਲੁਜ ਦਰਿਆ ਉੱਤੇ ਪੰਜਾਬ ਰਾਜ ਰਾਜ ਵਿੱਚ ਬਣਾਇਆ ਗਿਆ ਸੀ ਅਤੇ ਇਹ ਸ਼ਿਵਾਲਿਕ ਹਿਮਾਚਲ ਦੇ ਹੇਠਲੇ ਪਾਸੇ ਬਣਾਇਆ ਗਿਆ ਹੈ ਇਹ ਜਗ੍ਹਾ ਬਹੁਤ ਜ਼ਿਆਦਾ ਵਧੀਆ ਹੈ ਅਤੇ ਦੂਰ ਦੂਰ ਤੋਂ ਦੂਰ ਦੂਰ ਤੋਂ ਇਸ ਨੂੰ ਲੋਕ ਵੇਖਣ ਆਉਂਦੇ ਹਨ